ਖੇਤੀਬਾੜੀ ਉਤਪਾਦ ਜੋ ਕਿ ਕਿਸਾਨ ਤਿਆਰ ਕਰਦਾ ਹੈਗਾ ਫੇਰ ਉਸਨੂੰ ਮੰਡੀ 'ਚ ਲੈ ਕੇ ਜਾਂਦਾ ਅਤੇ ਵੇਚਦਾ ਗਾ ਜ਼ਿਆਦਾਤਰ ਸਬਜ਼ੀਆਂ ਦਾ ਸ਼ੋਸ਼ਣ ਜ਼ਿਆਦਾ ਹੁੰਦਾ ਇਸ 'ਚ ਕਿਸਾਨ ਦਾ ਕਿਉਂਕਿ ਸਬਜ਼ੀ ਦਾ ਕੋਈ ਐਮ ਐਸ ਪੀ ਨਹੀਂ ਹੈ ਕਿਉਂਕਿ ਸਰਕਾਰ ਵੱਲੋਂ ਨਿਸ਼ਚਿਤ ਹੋਇਆ ਹੁੰਦਾ ਅਤੇ ਜੋ ਮੰਨ ਲਓ ਹੁਣ ਕਿਸਾਨ ਆ ਦਸ ਰੁਪਏ ਸਬਜ਼ੀ ਵੇਚੀ ਕੋਈ ਵੀ ਉਹਨੇ ਮੰਡੀ 'ਚ ਲੈ ਕੇ ਗਿਆ ਇੱਥੋਂ ਪਹਿਲਾਂ ਲੈ ਕੇ ਜਾਣੀ ਪੈਂਦੀ ਹੈ ਟਰਾਂਸਪੋਰਟ ਦਾ ਖਰਚਾ ਪੈਂਦਾ ਫੇਰ ਇੱਥੇ ਸਾਰੇ ਉਗਾਈ ਉਹਨੇ ਖਰਚਾ ਕੀਤਾ ਉੱਥੇ ਫੇਰ ਆੜ੍ਹਤੀਏ ਦਾ ਕਮਿਸ਼ਨ ਹੈ ਅੱਗੇ ਮੰਡੀ ਦਾ ਖਰਚਾ ਹੁੰਦਾ ਹੈਗਾ ਫੇਰ ਉਹ ਜਿਹੜਾ ਕੋਈ ਲੈਂਦਾ ਗਾ ਉਹ ਸਮਾਂ ਦੀ ਜ਼ਿਆਦਾ ਮੁਨਾਫਾ ਲੈ ਜਾਂਦਾ ਗਾ ਹਾਲਾਂਕਿ ਕਿਸਾਨ ਨੂੰ ਐਨਾ ਮੁਨਾਫਾ ਜ਼ਿਆਦਾ ਨਹੀਂ ਹੁੰਦਾ ਕਿਸਾਨ ਨੂੰ ਮੁਨਾਫਾ ਉਦੋਂ ਹੁੰਦਾ ਜਦੋਂ ਦਸ ਰੁਪਏ ਵਾਲੀ ਚੀਜ਼ ਤੀਹ ਰੁਪਇਆਂ ਜਾਂ ਚਾਲੀ ਰੁਪਇਆਂ 'ਚ ਵਿਕੇ ਉਦੋਂ ਜ਼ਿਆਦਾ ਮੁਨਾਫਾ ਹੁੰਦਾ ਨਹੀਂ ਤਾਂ ਜ਼ਿਆਦਾ ਮੁਨਾਫਾ ਤਾਂ ਜੋ ਵੇ ਲੈ ਕੇ ਵੇਚਦਾ ਹੈਗਾ ਬਹਿ ਕੇ ਵੇਚਦਾ ਉੱਥੇ ਵੇਚਦਾ ਗਾ ਅਤੇ ਉਹ ਕੰਮ ਇਹ ਕਰਦਾ ਸਾਰਾ ਆਪਦਾ ਉਹਨੂੰ ਜ਼ਿਆਦਾ ਮੁਨਾਫਾ ਹੁੰਦਾ ਇੱਥੇ ਹੋਰ ਨਹੀਂ ਕਿਸਾਨ ਨੂੰ ਐਨਾ ਜ਼ਿਆਦਾ ਨਹੀਂ ਮੁਨਾਫਾ ਹੁੰਦਾ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਕਈ ਸਾਹਮਣੇ ਕਰਨੀਆਂ ਪੈਂਦੀਆਂ ਕਈ ਵਾਰੀ ਪਾਣੀ ਲਾਉਣ ਲਈ ਟਾਈਮ 'ਤੇ ਨਹਿਰ ਬੰਦ ਹੋ ਜਾਂਦੀ ਹੈ ਜਾਂ ਕੋਈ ਬਿਜਲੀ ਸਪਲਾਈ ਬਜ ਬੰਦ ਹੋ ਜਾਂਦੀ ਹੈ ਹਨੇਰੀ ਨਾਲ ਹੋ ਗਈ ਇਹਦੇ ਨਾਲ ਹੋ ਗਈ ਇਹ ਚੀਜ਼ਾਂ ਕਾਫੀ ਮੁਸ਼ਕਲਾਂ ਆਉਂਦੀਆਂ